ਪੰਜਾਬ ਦੇ ਵਿੱਚ ਜਿਹੜੀ ਪਿੰਡਾਂ ਦੇ ਸਰਕਾਰੀ ਸਕੂਲ ਹਨ ਉਹਨਾਂ ਦੇ ਵਿੱਚ ਦਾਖਲੇ ਦੀ ਪ੍ਰਕਿਰਿਆ ਇਸ ਤਰ੍ਹਾਂ ਹੈ ਕਿ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਵਾ ਦਿੱਤਾ ਜਾਂਦਾ ਗਾ ਤਾਂ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਦਾਖਲ ਕਰਵਾਉਣ ਦੇ ਸਮੇਂ ਤੁਹਾਨੂੰ ਬੱਚੇ ਦੀ ਜਿਹੜੀ ਜਨਮ ਮਿਤੀ ਹੁੰਦੀ ਆ ਜਨਮ ਸਰਟੀਫਿਕੇਟ ਬੱਚੇ ਦਾ ਆਧਾਰ ਕਾਰਡ ਮਾਤਾ ਪਿਤਾ ਦਾ ਆਧਾਰ ਕਾਰਡ ਬੱਚੇ ਦੀਆਂ ਫੋਟੋਆਂ ਇਹ ਦਸਤਾਵੇਜ਼ ਸਾਨੂੰ ਦਿਖਾਉਣੇ ਪੈਂਦੇ ਹਨ ਅਤੇ ਸ਼ੁਰੂ ਦੇ ਵਿੱਚ ਦਾਖਲੇ ਦੀ ਬ ਬਿਲਕੁਲ ਥੋੜ੍ਹੀ ਫੀਸ ਹੁੰਦੀ ਆ ਜਿਹੜੀ ਕਿ ਜਮਾਂ ਕਰਵਾਉਣੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਜਿਹੜੀਆਂ ਪੁਸਤਕਾਂ ਹੁੰਦੀਆਂ ਹਨ ਉਹਨੂੰ ਬਿਲਕੁਲ ਫਰੀ ਦਿੱਤੀਆਂ ਜਾਂਦੀਆਂ ਨੇ ਬੱਚੇ ਨੂੰ ਅਤੇ ਇਸ ਤੋਂ ਬਾਅਦ ਹੋਣ ਵਾਲੀ ਪੜ੍ਹਾਈ ਹੈ ਜਿਹੜੀ ਉਹ ਬਿਲਕੁਲ ਹੀ ਮੁਫ਼ਤ ਦੇ ਵਿੱਚ ਕਰਵਾਈ ਜਾਂਦੀ ਹੈ ਹਰੇਕ ਕਲਾਸ ਦੇ ਵਿੱਚ ਜਦੋਂ ਬੱਚਾ ਦਾਖਲ ਹੁੰਦਾ ਤਾਂ ਉਹਨਾਂ ਨੂੰ ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਦਾਖਲਾ ਫੀਸ ਲਈ ਜਾਂਦੀ ਹੈ ਪਰੰਤੂ ਇਸ ਤੋਂ ਇਲਾਵਾ ਜਿਹੜੀ ਹੋਰ ਕੋਈ ਵੀ ਫੀਸ ਆ ਉਹਨਾਂ ਤੋਂ ਨਹੀਂ ਲਈ ਜਾਂਦੀ ਅਤੇ ਅਗਲੀਆਂ ਕਲਾਸਾਂ ਵੱਡੀਆਂ ਕਲਾਸਾਂ ਦੇ ਵਿੱਚ ਵੀ ਉਹਨਾਂ ਦੀ ਦਾਖਲਾ ਪ੍ਰਕਿਰਿਆ ਇਸ ਤਰ੍ਹਾਂ ਹੀ ਕੀਤੀ ਜਾਂਦੀ ਹੈ